ਪ੍ਰੈਸ਼ਰ ਕੁੱਕਰ ਬਾਰੇ ਸਾਡਾ ਖਿਆਲ ਹੈ ਵੀ ਉਹ ਜਿਹੜੀ ਕੋਈ ਸਬਜ਼ੀ ਵਗੈਰਾ ਬਣਾਵਾਂਗੇ ਜਾਂ ਕੋਈ ਦਾਲ ਵਗੈਰਾ ਬਣਾਵਾਂਗੇ ਇੰਨੀ ਤੇਜ਼ ਹੀਟ ਲੈਂਦਾ ਹੈ ਉਹ ਅਤੇ ਤੇਜ ਹੀਟ ਨਾਲ ਕੋਈ ਵੀ ਚੀਜ਼ ਬਣਾ ਲਓ ਇੱਕੇ ਲਾਗਤ ਬਣਦੀ ਹੈ ਪਰ ਉਹਦੇ ਵਿੱਚ ਇੱਕ ਆਪਾਂ ਦੇਖਣਾ ਵੀ ਸਮਾਂ ਘੱਟ ਲੱਗਦਾ ਹੈ ਪਰ ਨਾਲ ਉਹਦਾ ਨੁਕਸਾਨ ਵੀ ਹੈ ਨੁਕਸਾਨ ਇਹ ਹੈ ਵੀ ਜੋ ਚੀਜ਼ ਜਿੰਨੀ ਗਲਣੀ ਚਾਹੀਦੀ ਹੈ ਕੁੱਕਰ 'ਚ ਪੱਕਣੀ ਚਾਹੀਦੀ ਹੈ ਉਹਦੇ ਨਾਲੋਂ ਕਈ ਗੁਣਾਂ ਵੱਧ ਉਹ ਪੱਕ ਜਾਂਦੀ ਹੈ ਅਤੇ ਜਿਹੜੇ ਉਹਦੇ ਗੁਣ ਅਸੀਂ ਸਾਨੂੰ ਖਾਣ ਵਾਸਤੇ ਚਾਹੀਦੇ ਨੇ ਜਿਵੇਂ ਕੱਦੂ ਦੀ ਸਬਜ਼ੀ ਜਾਂ ਕੋਈ ਹੋਰ ਹੈ ਉਹ ਸਾਨੂੰ ਨਹੀਂ ਮਿਲਦੇ ਇਸ ਤੋਂ ਇਲਾਵਾ ਪ੍ਰੈਸ਼ਰ ਕੁੱਕਰ ਦੇ ਵਿੱਚ ਖ਼ਤਰਾ ਵੀ ਹੈ ਇੱਕ ਸੀਟੀ ਲੱਗੀ ਹੁੰਦੀ ਹੈ ਉਹ ਵੱਜਦੀਆਂ ਨੇ ਦੋ ਤਿੰਨ ਫਿਰ ਆਪਾਂ ਉਹਨੂੰ ਬੰਦ ਕਰਦੇ ਹੈ ਕਈ ਵਾਰ ਕੀ ਹੁੰਦਾ ਹੈ ਵੀ ਪ੍ਰੈਸ਼ਰ ਕੁੱਕਰ ਦੀ ਸੀਟੀ ਬੰਦ ਹੋ ਜਾਂਦੀ ਹੈ ਅਸੀਂ ਅਚਨਚੇਤ ਅਚਾਨਕ ਉਧਰ ਖਿਆਲ ਹੀ ਨਹੀਂ ਕਰਦੇ ਸਾਨੂੰ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਹੀਟ ਨਾਲ ਗਰਮੈਸ਼ ਨਾਲ ਭੜਾਕਾ ਪੈ ਜਾਂਦਾ ਹੈ ਅਤੇ ਉਹਦਾ ਬਹੁਤ ਵੱਡਾ ਨੁਕਸਾਨ ਸਾਨੂੰ ਉਠਾਉਣਾ ਪੈਂਦਾ ਹੈ ਇਸ ਕਰਕੇ ਪ੍ਰੈਸ਼ਰ ਕੁੱਕਰ ਨਾਲੋਂ ਅਸੀਂ ਜ਼ਿਆਦੇ ਤਰਜੀਹ ਖੁੱਲੇ ਭਾਂਡੇ ਕੜਾਹੀ ਹੋਗੀ ਪਤੀਲੀ ਹੋਗੀ ਮਿੱਟੀ ਦੇ ਭਾਂਡੇ ਤਪਲਾ ਹੋ ਗਿਆ ਕਾੜ੍ਹਨੀ ਹੋਗੀ ਤੁਸੀਂ ਲਾ ਲਓ ਵੀ ਖੁੱਲ੍ਹੇ ਭਾਂਡੇ 'ਚ ਕੱਦੂ ਦੀ ਸਬਜ਼ੀ ਬਣਾ ਲਓ ਹੌਲੀ ਹੌਲੀ ਪੱਕੂਗੀ ਉਹ ਕੋਈ ਵੀ ਦਾਲ ਪਾਣੀ ਬਣਾ ਲਓ ਉਹ ਟੈਮ ਲੈ ਕੇ ਪੱਕੂਗੀ ਉਹਦਾ ਸੇ ਟੇਸਟ ਵੀ ਹੋਰ ਹੋਊ ਉਹਦਾ ਸੁਆਦ ਵੀ ਹੋਰ ਹੋਊ ਉਹਦਾ ਗੁਣ ਵੀ ਵੱਧ ਹੋਣਗੇ ਇਸੇ ਤਰੀਕੇ ਨਾਲ ਕੜਾਹੀ ਹੈ ਕੜਾਹੀ ਦੇ ਵਿੱਚ ਖੁੱਲ੍ਹੇ ਭਾਂਡੇ 'ਚ ਤੁਸੀਂ ਜਿਵੇਂ ਕੁਛ ਚੰਗੀ ਸਬਜ਼ੀ ਕਰੇਲੇ ਵਗੈਰਾ ਬਣਾਉਣੇ ਹੈ ਉਹ ਵਧੀਆ ਬਣਨਗੇ ਨਾ ਕਿ ਕੁੱਕਰ 'ਚ ਬਣਨਗੇ ਇਸੇ ਤਰ੍ਹਾਂ ਹੀ ਕਾੜ੍ਹਨੀ ਹੈ ਕਾੜ੍ਹਨੀ ਦੇ ਵਿੱਚ ਦੁੱਧ ਉੱਬਲ ਉੱਬਲ ਕੇ ਲਾਲ ਹੋ ਜਾਂਦਾ ਹੈ ਉਧੂ ਬਾਅਦ ਉਹ ਬਹੁਤ ਬਹੁਤ ਹਲਕੇ ਸੇਕ ਨਾਲ ਹੁੰਦਾ ਹੈ ਉਹ ਤਿਆਰ ਅਤੇ ਸ ਸਾਨੂੰ ਪੀਣ 'ਚ ਵੀ ਟੇਸਟੀ ਹੈ ਊਂ ਵੀ ਤਾਕਤਵਾਰ ਹੈ ਅਤੇ ਉਧੂ ਬਾਅਦ ਅਸੀਂ ਉਹਨੂੰ ਜਮਾ ਕੇ ਘਿਓ ਵਗੈਰਾ ਬਣਾਉਂਦੇ ਲੱਸੀ ਵਗੈਰਾ ਬਣਾਉਂਦੇ ਹਾਂ ਇਹ ਕਾੜ੍ਹਨੀ ਦਾ ਬਹੁਤ ਫ਼ਾਈਦਾ ਹੈ ਦੂਜੇ ਪਾਸੇ ਆਹ ਜੋ ਸਾਗ ਹੈ ਜੇ ਕੁੱਕਰ 'ਚ ਬਣਾਈਏ ਉਹ ਗੱਲ ਬਣਦੀ ਨਹੀਂ ਉੱਨਾ ਟੇਸਟ ਨਹੀਂ ਹੁੰਦਾ ਉਨਾ ਘੁਲਦਾ ਨਹੀਂ ਵਧੀਆ ਜੇ ਜ਼ਿਆਦੇ ਪੱਕ ਜਾਂਦਾ ਜ਼ਿਆਦੇ ਘੁੱਲ ਜਾਂਦਾ ਉਹਦਾ ਟੇਸਟ ਨਹੀਂ ਰਹਿੰਦਾ ਇਸ ਕਰਕੇ ਪ੍ਰੈਸ਼ਰ ਕੁੱਕਰ ਨਾਲੋਂ ਜੇ ਅਸੀਂ ਤਪਲੇ ਦੇ ਵਿੱਚ ਸਾਗ ਬਣਾਈਏ ਮੱਠੀ ਅੱਗ 'ਤੇ ਸਾਗ ਬਣਾਈਏ ਉਹ ਬਹੁਤ ਹੀ ਗੁਣਕਾਰੀ ਅਤੇ ਬਹੁਤ ਟੇਸਟੀ ਬਣਦਾ ਹੈ ਇਸ ਕਰਕੇ ਪ੍ਰੈਸ਼ਰ ਕੁੱਕਰ ਨਾਲੋਂ ਅਸੀਂ ਖੁੱਲੇ ਭਾਂਡਿਆਂ ਨੂੰ ਮਿੱਟੀ ਦੇ ਭਾਂਡਿਆਂ ਨੂੰ ਤਰਜੀਹ ਦਿੰਦੇ ਹੈ ਇਹ ਭਾਂਡੇ ਬਹੁਤ ਹੀ ਗੁਣਕਾਰੀ ਨੇ ਬਹੁਤ ਹੀ ਫ਼ਾਇਦੇ ਵਾਲੇ ਹੁੰਦੇ ਨੇ